ਪੰਜਾਬ ਵਿੱਚ ਲੋਕ ਸੱਭਿਆਚਾਰ ਵਿਰਾਸਤ ਨੂੰ ਬਹੁਤ ਹੀ ਸੋਹਣੇ ਢੰਗ ਨਾਲ ਮਨਾਉਂਦੇ ਨੇ ਪੰਜਾਬੀਆਂ ਦਾ ਕੰਮ ਹੀ ਨੱਚਣਾ ਖੁਸ਼ੀ ਮਨਾਉਣਾ ਹੈ ਉਹ ਆਪਣੇ ਹਰ ਇੱਕ ਤਿਉਹਾਰ ਨੂੰ ਖੁਸ਼ੀ ਮੌਕੇ ਵਿਆਹ ਮੌਕੇ ਜਨਮਦਿਨ ਮੌਕੇ ਨਵੇਂ ਜੰਮੇ ਬੱਚੇ ਮੌਕੇ ਭੰਗੜੇ ਪਾਉਂਦੇ ਹਨ ਨੱਚਦੇ ਟੱਪਦੇ ਹਨ ਅਤੇ ਆਪਣੇ ਸੱਭਿਆਚਾਰ ਨੂੰ ਦਿਖਾਉਂਦੇ ਨੇ ਜਿਵੇਂ ਕਿ ਭੰਗੜੇ ਨੂੰ ਲੈ ਲਓ ਭੰਗੜੇ ਦੇ ਜੋ ਸਾਰੇ ਸਟੈਪ ਹਨ ਉਹ ਪੰਜਾਬੀ ਸੱਭਿਆਚਾਰ ਨੂੰ ਦਿਖਾਉਣ ਵਿੱਚ ਮਦਦ ਕਰਦੇ ਨੇ ਜਿਵੇਂ ਕਿ ਜਿਊਣਾ ਮੋੜ ਧਮਾਲ ਹੈਗੀ ਹੈ ਪੰਜਾਬ ਹੈ ਗਿੱਧਾ ਅਤੇ ਭੰਗੜੇ ਦੇ ਜੋ ਸਾਜ਼ ਨੇ ਉਹ ਵੀ ਐਸੇ ਨੇ ਜੋ ਕਿ ਪੰਜਾਬ ਦੀ ਫੁਰਤੀ ਨੂੰ ਦਿਖਾਉਂਦੇ ਨੇ ਸੱਭਿਆਚਾਰ ਦਾ ਯੋਗਦਾਨ ਜੋ ਲੋਕ ਨਾਚਾਂ ਵਿੱਚੋਂ ਦੇਖਣ ਨੂੰ ਮਿਲਦਾ ਲੋਕ ਨਾਚ ਹੀ ਜੋ ਪੰਜਾਬ ਦੀ ਆਨ ਸ਼ਾਨ ਨੂੰ ਲੋਕਾਂ ਸਾਹਮਣੇ ਜਾਂ ਹੋਰ ਰਾਜਾਂ ਸਾਹਮਣੇ ਦਿਖਾਉਣ ਵਿੱਚ ਮਦਦ ਕਰਦੇ ਹਨ